ਟਰੈਕਿੰਗ ਸਾਈਡਾਂ 'ਤੇ ਪਹਿਲੇ ਤੋਂ ਜ਼ਿਆਦਾ ਬਹੁਤ ਹੀ ਜ਼ਿਆਦਾ ਕੂੜਾ ਕਰਕਟ ਗੰਦਗੀ ਫੈਲਦੀ ਜਾ ਰਹੀ ਹੈ ਕਿਉਂਕਿ ਲੋਕ ਉੱਥੇ ਬਹੁਤ ਜਾਣ ਲੱਗ ਪਏ ਨੇ ਉਸ ਤੋਂ ਬਾਅਦ ਕਿ ਜਿਹੜੇ ਵੀ ਲੋਕ ਉੱਥੋਂ ਟਰੈਕਿੰਗ ਸਾਈਡਾਂ 'ਤੇ ਜਾਂਦੇ ਨੇ ਉੱਥੇ ਆਪਣਾ ਜੋ ਵੀ ਸਮਾਨ ਹੁੰਦਾ ਖਾਣ ਪੀਣ ਦਾ ਸਮਾਨ ਕੁਛ ਵੀ ਹੈ ਉੱਥੇ ਖਾ ਪੀ ਕੇ ਅਤੇ ਉੱਥੇ ਹੀ ਸੁੱਟ ਦਿੰਦੇ ਨੇ ਜੋ ਕਿ ਬਹੁਤ ਗਲਤ ਗੱਲ ਹੈ ਟਰੈਕਿੰਗ ਸਾਈਡਾਂ 'ਤੇ ਜਾ ਕੇ ਆਪਣਾ ਜੋ ਵੀ ਖਾਣ ਪੀਣ ਦਾ ਸਮਾਨ ਹੁੰਦਾ ਹੈ ਖਾ ਪੀ ਕੇ ਅਤੇ ਆਪਣਾ ਥੋੜ੍ਹਾ ਬਹੁਤਾ ਪੈਕਜ ਵਗੈਰਾ ਉਹ ਨਾਲ ਹੀ ਲੈ ਕੇ ਆਉਣੇ ਚਾਹੀਦੇ ਆ ਕਿਉਂਕਿ ਲੋਕ ਉੱਥੇ ਹੀ ਸੁੱਟ ਕੇ ਆ ਜਾਂਦੇ ਨੇ ਵਾਤਾਵਰਨ ਨੂੰ ਸਾਫ ਰੱਖਣ ਲਈ ਮੇਰੇ ਵੱਲੋਂ ਮੈਂ ਤਾਂ ਜਦੋਂ ਜਾਂਦਾ ਟਰੈਕਿੰਗ 'ਤੇ ਅਤੇ ਮੈਂ ਆਪਣਾ ਜੋ ਵੀ ਸਮਾਨ ਆ ਜੋ ਵੀ ਕੁਛ ਨਾਲ ਲੈ ਕੇ ਜਾਂਦਾ ਅਤੇ ਸਭ ਨਾਲ ਹੀ ਲੈ ਕੇ ਆਉਂਦਾ ਕੋਈ ਵੀ ਗੰਦਗੀ ਕੋਈ ਵੀ ਪੈਕਟ ਹੋ ਗਿਆ ਕੋਈ ਵੀ ਖਾਣ ਪੀਣ ਦਾ ਕੁਛ ਵੀ ਹੈ ਉੱਥੇ ਸੁੱਟ ਕੇ ਨਹੀਂ ਆਉਂਦਾ ਖਾ ਖਾ ਕੇ ਆਪਣੇ ਬੈਗ ਵਿੱਚ ਰੱਖਦਾ ਅਤੇ ਨੀਚੇ ਆ ਕੇ ਸੁੱਟ ਦਿੰਦਾ ਟਰੈਕਿੰਗ ਸਾਈਡਾਂ ਨੂੰ ਖੂਬਸੂਰਤ ਤਾਂ ਹੀ ਬਣਾਇਆ ਜਾ ਸਕਦਾ ਹੈ ਕਿ ਉੱਥੇ ਸਾਫ ਸਫਾਈ ਆਪਣੇ ਵੱਲੋਂ ਰੱਖੀ ਜਾਵੇ ਸਕੇ ਸਾਡਾ ਹੀ ਜਿੰਮੇਦਾਰੀ ਹੈ ਕਿ ਸਾਇਡਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ ਲੋਕ ਬਿਲਕੁਲ ਸਾਫ ਸੁਥਰਾ ਨਹੀਂ ਰੱਖਦੇ ਕਿਉਂਕਿ ਬਹੁਤ ਵੱਡੀ ਗਲਤ ਗੱਲ ਹੈਗੀ ਹੈ ਅਤੇ ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਟਰੈਕਿੰਗ ਸਾਈਡਾਂ ਨੂੰ ਸਾਫ ਸੁਥਰਾ ਰੱਖਣ ਲਈ ਉਹਨੂੰ ਆਪਣੇ ਸਾਡੇ ਜਿੰਮੇਦਾਰੀ ਹੈ ਤਾਂ ਕਿ ਆਪਾਂ ਜੋ ਵੀ ਆਪਣਾ ਸਮਾਨ ਵਗੈਰਾ ਕੁਛ ਵੀ ਲੈ ਕੇ ਜਾਈਏ ਅਤੇ ਉਹਨੂੰ ਐਜ ਇਟ ਇਜ ਸਮਾਨ ਵਾਪਸ ਲੈ ਕੇ ਆਈਏ ਉੱਥੇ ਸੁੱਟ ਕੇ ਨਾ ਆਈਏ ਇਸ ਲਈ